ਜਿਵੇਂ ਕਿ ਮੈਂ ਦੱਸਿਆ ਮੈਂ ਬਚਪਨ ਵਿੱਚ ਹੀ ਦੌੜ ਲਾਉਣ ਦਾ ਸ਼ੌਕੀਨ ਸੀ ਔਰ ਮੈਂ ਜਦੋਂ ਸਕੂਲ ਟਾਈਮ ਗੇਮਾਂ ਵਿੱਚ ਭਾਗ ਲੈਂਦਾ ਸੀ ਤਾਂ ਵੱਖ ਵੱਖ ਜਗ੍ਹਾ ਨੈਸ਼ਨਲ ਲੈਵਲ ਦੇ ਉੱਤੇ ਸਾਨੂੰ ਖੇਡਣ ਦਾ ਮੌਕਾ ਮਿਲਿਆ ਅਸੀਂ ਇੱਕ ਵਾਰੀ ਦਿੱਲੀ ਨੈਸ਼ਨਲ ਦੌੜਾਂ ਵਿੱਚ ਖੇਡਣ ਗਏ ਤਾਂ ਉੱਥੇ ਵੱਖ ਵੱਖ ਜ਼ਿਲ੍ਹਿਆ ਔਰ ਵੱਖ ਵੱਖ ਸਟੇਟਾਂ ਦੇ ਲੋਕ ਖੇਡਣ ਲਈ ਆਏ ਹੋਏ ਸਨ ਉਹਨਾਂ ਵਿੱਚ ਇੱਕ ਬਹੁਤ ਹੀ ਮੋਟਾ ਆਦਮੀ ਦੌੜਾਂ ਵਿੱਚ ਭਾਗ ਲੈਣ ਲਈ ਇੱਕ ਲੜਕਾ ਆਇਆ ਹੋਇਆ ਸੀ ਉਹ ਜਦੋਂ ਸਾਡੇ ਨਾਲ ਉਸ ਨੇ ਦੌੜਨਾ ਆਰੰਭ ਕੀਤਾ ਔਰ ਥੋੜ੍ਹੀ ਹੀ ਦੂਰ ਜਾ ਕੇ ਉਹ ਡਿੱਗ ਪਿਆ ਸਾਰਾ ਹੀ ਪਬਲਿਕ ਵੇਖ ਕੇ ਉਹਨੂੰ ਉੱਚੀ ਉੱਚੀ ਹੱਸਣ ਲੱਗ ਪਈ ਔਰ ਉਹ ਅੱਜ ਵੀ ਜਦੋਂ ਕਿਤੇ ਮੈਨੂੰ ਉਹ ਸੀਨ ਚੇਤੇ ਆਉਂਦਾ ਹੈ ਤਾਂ ਮੇਰਾ ਆਪ ਮੁਹਾਰੇ ਹੀ ਹਾਸਾ ਨਿਕਲ ਜਾਂਦਾ ਹੈ ਇਵੇਂ ਕਈ ਤਰ੍ਹਾਂ ਦੀਆਂ ਸਟੇਟਾਂ ਦੇ ਲੋਕ ਆਏ ਸਨ ਤਾਂ ਅਸੀਂ ਮਜੇਦਾਰ ਪਲ ਬਤੀਤ ਕੀਤੇ ਔਰ ਵੱਖ ਵੱਖ ਲੋਕਾਂ ਨਾਲ ਆਪਣੇ ਸਮੇਂ ਦੇ ਹਾਸੇ ਜੋ ਅਸੀਂ ਸਾਂਝੇ ਕੀਤੇ ਅੱਜ ਵੀ ਜਦੋਂ ਕਿਤੇ ਉਹ ਮੋਟੇ ਆਦਮੀ ਦਾ ਮੈਨੂੰ ਚੇਤਾ ਆਉਂਦਾ ਹੈ ਤਾਂ ਮੈਨੂੰ ਬਹੁਤ ਹੀ ਹਾਸਾ ਆਉਂਦਾ ਹੈ ਉਹ ਮੇਰੇ ਲਈ ਬਹੁਤ ਹੀ ਯਾਦਗਾਰ ਪਲ ਸਨ